ਬੁਣਾਈ ਅਤੇ ਸਿਲਾਈ ਦੇ ਲਈ ਮਹੱਤਵਪੂਰਨ ਜਿੱਦਾਂ ਬੁਣਾਈ ਦੇ ਲਈ ਆਪਾਂ ਨੂੰ ਪਸਮ ਜ਼ਰੂਰੀ ਹੁੰਦੀ ਹੈਗੀ ਸਲਾਈਆਂ ਜ਼ਰੂਰੀ ਹੁੰਦੀਆਂ ਨੇ ਜਿਹਦੇ ਨਾਲ ਆਪਾਂ ਬੁਣਾਈ ਕਰ ਸਕਦੇ ਹਾਂਗੇ ਸਿਲਾਈ ਦੇ ਲਈ ਮਸ਼ੀਨਾਂ ਜ਼ਰੂਰੀ ਹੁੰਦੀਆਂ ਨੇ ਮਸ਼ੀਨਾਂ ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇਗੀਆਂ ਸਿਲਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਜਿੱਦਾਂ ਟੂਲਸ ਟੂਲ ਦੀ ਕਿੱਟ ਦੇ ਵਿੱਚ ਇੰਚੀਟੇਪ ਕੈਂਚੀ ਚੋਕ ਕਟਿੰਗ ਟੇਬਲ ਪ੍ਰੈਸ ਵਗੈਰਾ ਇਹਨਾਂ ਦੀ ਜ਼ਰੂਰਤ ਪੈਂਦੀ ਹੈ ਜਦੋਂ ਸਿਲਾਈ ਕਰਦੇ ਹਾਂ ਮੈਂ ਸਿਲਾਈ ਦੇ ਲਈ ਆਪਾਂ ਨੂੰ ਥਰੈਡ ਵਗੈਰਾ ਧਾਗੇ ਅਲੱਗ ਅਲੱਗ ਤਰ੍ਹਾਂ ਦੀਆਂ ਰੀਲਾਂ ਦੀ ਜ਼ਰੂਰਤ ਪੈਂਦੀ ਹੈ ਜਿੱਦਾਂ ਦਾ ਕੱਪੜਾ ਹੁੰਦਾ ਉਦਾਂ ਦੀ ਰੀਲ ਦੀ ਜ਼ਰੂਰਤ ਪੈਂਦੀ ਹੈਗੀ ਐਸਐਮ ਮਸ਼ੀਨਾਂ ਮਸ਼ੀਨਾਂ ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇਗੀਆਂ ਸਿੰਪਲ ਮਸ਼ੀਨ ਹੋ ਗਈ ਮਰੀਲਾ ਮਸ਼ੀਨ ਹੋ ਗਈ ਇੰਟਰਲੋਕ ਵਾਲੀ ਮਸ਼ੀਨ ਹੋ ਗਈ ਪਾਵਰ ਵਾਲੀਆਂ ਮਸ਼ੀਨਾਂ ਜਿੱਦਾਂ ਇੰਟ ਆਪਣੀ ਅਮਰੇਲਾ ਮਸ਼ੀਨ ਹੋਗੀ ਪਾਵਰ ਵਾਲੀ ਮਸ਼ੀਨ ਹੁੰਦੀ ਆ ਇਹਦੇ ਨਾਲ ਕੰਮ ਜਲਦੀ ਨਿੱਬੜ ਜਾਂਦਾ ਆ ਸਿੰਪਲ ਮਸ਼ੀਨ ਪੈਰਾਂ ਵਾਲੀ ਮਸ਼ੀਨ ਹੁੰਦੀ ਆ ਪੈਰਾਂ ਵਾਲੀ ਮਸ਼ੀਨ ਅਤੇ ਆਪਣੀ ਹੱਥਾਂ ਵਾਲੀ ਮਸ਼ੀਨ ਨਾਲ ਥੋੜ੍ਹਾ ਹੋਰ ਜਲਦੀ ਕੰਮ ਨਿੱਬੜ ਜਾਂਦਾ ਹੈਗਾ ਅਤੇ ਉਣ ਉਣ ਆਪਣੀ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਹੈਗੀ ਤਿੰਨ ਪਲਾਈ ਉਣ ਹੋ ਗਈ ਆਪਣੀ ਗੋਲ ਉਣ ਹੋ ਗਈ ਗੋਲ ਉਣ ਥੋੜ੍ਹੀ ਜ਼ਿਆਦਾ ਸਫਾਈ ਆਉਂਦੀ ਆ ਤਿੰਨ ਪਲਾਈ ਨਾਲੋਂ ਬਟ ਆਪਣੇ ਬੁਣਨ 'ਤੇ ਡਿਪੈਂਡ ਕਰਦਾ ਗਾ ਉਸ ਤੋਂ ਬਾਅਦ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਜਿੱਦਾਂ ਆਪਣੀਆਂ ਹੁਣ ਡਿਜੀਟਲ ਮਸ਼ੀਨਾਂ ਆਈਆਂ ਨੇਗੀਆ ਕਢਾਈ ਵਾਲੀਆਂ ਮਸ਼ੀਨਾਂ ਹੋ ਗਈਆਂ ਕਢਾਈ ਦੇ ਮੂਹਰੀਆ 'ਤੇ ਕਢਾਈ ਕੀਤੀ ਜਾ ਸਕਦੀ ਹੈਗੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈਗੀ ਬਣੀ ਹੋਈ ਇੱਦਾਂ ਆਪਾਂ ਅਲੱਗ ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਖਰੀਦ ਕੇ ਅਲੱਗ ਅਲੱਗ ਤਰ੍ਹਾਂ ਦੀ ਕਢਾਈ ਕਰਕੇ ਸਲਾਈ ਅਤੇ ਬੁਣਾਈ ਨੂੰ ਬਹੁਤ ਵਧੀਆ ਬਣਾ ਸਕਦੇ ਆਗੇ